ਸਤਿ ਸ਼੍ਰੀ ਅਕਾਲ ਜੀ ਜੀ ਹਾਂ ਬਿਲਕੁਲ ਸ਼ੁਰੂਆਤ ਦੇ ਦਿਨਾਂ ਵਿੱਚ ਮੈਨੂੰ ਬੜਾ ਡਰ ਅਤੇ ਘਬਰਾਹਟ ਮਹਿਸੂਸ ਹੁੰਦੀ ਸੀ ਜ਼ਿਆਦਾ ਵੱਡੀ ਆਡੀਅੰਸ ਦੇ ਅੱਗੇ ਪਰਫੋਰਮ ਕਰਦੇ ਹੋਏ ਅਤੇ ਹੁਣ ਤਾਂ ਕਾਫ਼ੀ ਮੇਰਾ ਹੌਂਸਲਾ ਖੁੱਲ੍ਹ ਗਿਆ ਹੈ ਅਤੇ ਮੈਨੂੰ ਹੁਣ ਇੰਨਾ ਡਰ ਮਹਿਸੂਸ ਨਹੀਂ ਹੁੰਦਾ ਅਤੇ ਮੈਂ ਆਪਣੇ ਇਸ ਡਰ 'ਤੇ ਕਾਬੂ ਪਾਉਣ ਲਈ ਮੈਂ ਸਭ ਤੋਂ ਵੱਡਾ ਸ਼ਰੇਅ ਮੈਂ ਆਪਣੀ ਮਾਤਾ ਜੀ ਨੂੰ ਦੇਵਾਂਗੀ ਮੇਰੇ ਮੰਮੀ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ ਅਤੇ ਮੈਨੂੰ ਦੱਸਿਆ ਕਿ ਜਿੰਨੀ ਵਧੀਆ ਮੇਰੀ ਤਿਆਰੀ ਹੋਵੇਗੀ ਉੰਨਾ ਹੀ ਵਧੀਆ ਮੈਂ ਪਰਫੋਰਮ ਕਰ ਪਾਵਾਂਗੀ ਉਹਨਾਂ ਨੇ ਮੈਨੂੰ ਹਮੇਸ਼ਾਂ ਸਿਖਾਇਆ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਤਿਆਰੀ ਰੱਖੋ ਵਾਰ ਵਾਰ ਰਿਆਜ਼ ਕਰੋ ਅਤੇ ਸ਼ੀਸ਼ੇ ਮੂਹਰੇ ਖੜ੍ਹ ਕੇ ਗਾਓ ਆਪਣੇ ਦੋਸਤਾਂ ਨੂੰ ਅਤੇ ਆਪਣੇ ਘਰ ਦੇ ਮੈਂਬਰਾਂ ਨੂੰ ਸੁਣਾਓ ਜਿਸ ਨਾਲ ਤੁਹਾਡਾ ਹੌਂਸਲਾ ਖੁਲ੍ਹੇਗਾ ਮੇਰੀ ਮੰਮੀ ਨੇ ਹਮੇਸ਼ਾਂ ਮੇਰੇ ਗੀਤ ਸੁਣੇ ਅਤੇ ਉਹਨਾਂ ਨੇ ਮੈਨੂੰ ਵੱਧ ਤੋਂ ਵੱਧ ਤਿਆਰੀ ਰੱਖਣ ਲਈ ਕਿਹਾ ਅਤੇ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਉਹ ਮੈਨੂੰ ਹਮੇਸ਼ਾਂ ਸਿਖਾਉਂਦੇ ਹਨ ਕਿ ਜਦ ਵੀ ਸਟੇਜ 'ਤੇ ਜਾਣ ਤੋਂ ਪਹਿਲਾਂ ਡਰ ਲੱਗੇ ਤਾਂ ਲੰਮੇ ਸਾਹ ਲਉ ਜਿਸ ਨਾਲ ਤੁਹਾਡੀ ਦਿਲ ਦੀ ਧੜਕਣ ਨੋਰਮਲ ਹੋਵੇਗੀ ਅਤੇ ਤੁਹਾਡਾ ਮਨ ਸ਼ਾਂਤ ਹੋਵੇਗਾ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਜਿੰਨਾ ਹੋ ਸਕੇ ਤੁਸੀਂ ਆਡੀਅੰਸ ਦੇ ਨਾਲ ਗੱਲਬਾਤ ਕਰੋ ਜਿਸ ਨਾਲ ਤੁਹਾਡਾ ਹੌਂਸਲਾ ਖੁੱਲ੍ਹੇਗਾ ਕਿਉਂਕਿ ਦੇਖਿਆ ਜਾਵੇ ਤਾਂ ਇਹ ਡਰ ਬੜਾ ਹੀ ਸੁਭਾਵਿਕ ਹੈ ਪਰ ਇਹ ਕਦੀ ਵੀ ਡਰ ਸਾਡੇ ਸੁਪਨਿਆਂ ਦੇ ਰਾਹ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਮੈਂ ਇਹ ਗੱਲ ਮੰਨਦੀ ਹਾਂ ਅਤੇ ਮੈਂ ਬਾਕੀਆਂ ਨੂੰ ਵੀ ਇਹ ਹੀ ਸਿੱਖਿਆ ਦੇਣਾ ਚਾਹੂੰਗੀ ਵੀ ਕਿ ਜਿੰਨਾ ਹੋ ਸਕੇ ਆਪਣੇ ਡਰ 'ਤੇ ਕਾਬੂ ਪਾਉਣ ਲਈ ਆਪਣੀ ਤਿਆਰੀ ਨੂੰ ਪੱਕਾ ਰੱਖੋ ਅਤੇ ਨਾਲ ਸ਼ੁਰੂਆਤ ਦੇ ਦਿਨਾਂ ਵਿੱਚ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਬਈ ਤੁਸੀਂ ਘੱਟ ਆਡੀਅੰਸ ਦੇ ਅੱਗੇ ਪਰਫੋਰਮ ਕਰੋ ਜਿਹਦੇ ਨਾਲ ਤੁਹਾਡਾ ਹੌਂਸਲਾ ਖੁੱਲ੍ਹੇਗਾ